ਕਿਤਾਬਾਂ ਤੋਂ ਇਲਾਵਾ ਮੈਂ ਜ਼ਿਆਦਾਤਰ ਮੈਗਜ਼ੀਨ ਵਲੋਗ ਅਤੇ ਅਖ਼ਬਾਰ ਪੜ੍ਹਦੀ ਰਹਿੰਦੀ ਹਾਂ ਪਰ ਮੇਰਾ ਜ਼ਿਆਦਾ ਇੰਟਰਸਟ ਹੈਗਾ ਵਲੋਗ 'ਚ ਅਤੇ ਮੈਂ ਕਾਫੀ ਸਾਰੇ ਜਿਹੜੇ ਯੂਟਿਊਬ 'ਤੇ ਕਾਫੀ ਸਾਰਿਆਂ ਦੇ ਵਲੋਗ ਦੇਖਦੀ ਹਾਂ ਕੂਕਿੰਗ ਰਿਲੇਟਿਡ ਦੇਖਦੀ ਹਾਂ ਡਰੋਇੰਗ ਰਿਲੇਟਿਡ ਦੇਖਦੀ ਹਾਂ ਅਤੇ ਡਾਂਸ ਰਿਲੇਟਿਡ ਪਰ ਜ਼ਿਆਦਾਤਰ ਮੈਨੂੰ ਇਸ ਵਿੱਚ ਇੰਟਰਸਟ ਹੈ ਜਿਹੜਾ ਕਿ ਡਰੋਇੰਗ ਵਿੱਚ ਹੈ ਅਤੇ ਮੈਂ ਡਰੋਇੰਗ ਦੇ ਰਿਲੇਟਿਡ ਬਹੁਤ ਸਾਰੇ ਵਲੋਗ ਦੇਖਦੀ ਰਹਿੰਦੀ ਹਾਂ ਅਤੇ ਕਾਫੀ ਸਾਰੇ ਜਿਹੜੇ ਨਾਟਕਾਂ ਦੇ ਪ੍ਰਤੀ ਵੀ ਮੈਂ ਵਲੋਗ ਦੇਖਦੀ ਹਾਂ ਅਤੇ ਉਹਨਾਂ ਦੇ ਮੈਨੂੰ ਜਿਵੇਂ ਕਿ ਮੈਂ ਜ਼ਿਆਦਾਤਰ ਪਾਕਿਸਤਾਨੀ ਵਲੋਗਜ਼ ਦੇਖਦੀ ਹਾਂ ਅਤੇ ਮੈਨੂੰ ਉਹਨਾਂਦੇ ਕਲਚਰ ਬਾਰੇ ਵੀ ਜ਼ਿਆਦਾ ਪਤਾ ਲੱਗਦਾ ਹੈ ਅਤੇ ਉਹਨਾਂ ਦੇ ਬਹੁਤ ਸਾਰੇ ਚੀਜ਼ਾਂ ਬਾਰੇ ਪਤਾ ਲੱਗਦਾ ਨਵੀਆਂ ਨਵੀਆਂ ਚੀਜ਼ਾਂ ਬਾਰੇ ਮੈਂ ਦੇਖਦੀ ਰਹਿੰਦੀ ਹਾਂ ਅਤੇ ਕੂਕਿੰਗ ਦੇ ਰਿਲੇਟਿਡ ਵੀ ਉਹਨਾਂ ਦੇ ਵੱਖ ਵੱਖ ਤਰ੍ਹਾਂ ਦੀਆਂ ਜਿਵੇਂ ਕਿ ਕੀ ਪਕਵਾਨਾਂ ਹੁੰਦੀਆਂ ਨੇ ਉਸ ਰਿਲੇਟਿਡ ਉਹ ਮੈਨੂੰ ਬਹੁਤ ਸਾਰਾ ਜਿਹੜਾ ਮੈਂ ਦੇਖਦੀ ਹਾਂ ਅਤੇ ਉਸ ਰਿਲੇਟਿਡ ਮੈਨੂੰ ਬਹੁਤ ਹੀ ਜ਼ਿਆਦਾ ਕੁਛ ਪਤਾ ਲੱਗਦਾ ਹੈ ਉਹਨਾਂ ਦੇ ਕਲਚਰ ਬਾਰੇ ਅਤੇ ਮੈਂ ਸਿਰਫ਼ ਪਾਕਿਸਤਾਨੀ ਹੀ ਨਹੀਂ ਕਾਫੀ ਸਾਰੇ ਜਿਹੜੇ ਅਲੱਗ ਅਲੱਗ ਦੇਸ਼ਾਂ ਦੇ ਐਕਟਰਸ ਦੇ ਵੀ ਵਲੋਗ ਦੇਖਦੀ ਹਾਂ ਜਿਵੇਂ ਕਿ ਮੈਂ ਜ਼ਿਆਦਾਤਰ ਵਲੋਗ ਜਿਹੜਾ ਹੈ ਤਰਕਿਸ਼ ਐਕਟਰਸ ਦੇ ਵੀ ਦੇਖਦੀ ਹਾਂ ਅਤੇ ਉਹਨਾਂ ਦੇ ਵੀ ਰਿਲੇਟਿਡ ਮੈਨੂੰ ਕਾਫੀ ਸ ਕੁਛ ਪਤਾ ਲੱਗਦਾ ਹੈ ਕਾਫੀ ਉਹਨਾਂ ਦੇ ਕਲਚਰ ਬਾਰੇ ਮੈਨੂੰ ਬਹੁਤ ਜਾਣਕਾਰੀ ਮਿਲਦੀ ਹੈ ਅਤੇ ਉਹਨਾਂ ਦੇ ਕਾਫੀ ਸਾਰੇ ਵਧੀਆ ਸੀਰੀਅਲਸ ਵੀ ਆਉਂਦੇ ਨੇ ਜੋ ਕਿ ਵਧੀਆ ਜਿਹੜੇ ਰਿਲੇਟਿਡ ਹੁੰਦੇ ਨੇ ਜਿਹੜੇ ਕਿ ਆਪਣੇ ਸੋਸ਼ਰ ਸੋਸ਼ਲ ਦੇ ਕਲਚਰ ਰਿਲੇਟਿਡ ਹੁੰਦੇ ਨੇ ਅਤੇ ਮੈਂ ਹੋਰ ਵੀ ਜ਼ਿਆਦਾ ਲੋਕਾਂ ਦੇ ਵੀ ਵਲੋਗ ਦੇਖਦੀ ਹਾਂ ਇੰਡੀਅਨ ਦੇ ਐਕਟਰਸ ਦੇ ਵੀ ਮੈਂ ਕਾਫੀ ਵਲੋਗ ਦੇਖਦੀ ਹਾਂ ਅਤੇ ਔਰ ਸਟੱਡੀ ਰਿਲੇਟਿਡ ਵੀ ਮੈਂ ਕਾਫੀ ਵਲੋਗ ਦੇਖਦੀ ਹਾਂ ਜਦੋਂ ਮੈਨੇ ਪੜ੍ਹਾਈ ਕਰਨੀ ਹੁੰਦੀ ਹੈ ਤਾਂ ਮੈਂ ਸਟੱਡੀ ਰਿਲੇਟਿਡ ਯੂਟਿਊਬ 'ਤੇ ਵਲੋਗ ਦੇਖਦੀ ਹਾਂ ਜਿਹੜੀ ਕਿ ਉਹ ਵਲੋਗ ਹੈ ਮੀਥ ਹਬ ਸਟੱਡੀ ਦਾ ਉਹ ਬਹੁਤ ਹੀ ਜ਼ਿਆਦਾ ਵਧੀਆ ਸਮਝਾਉਂਦੇ ਨੇ ਇੱਕ ਇੱਕ ਚੀਜ਼ ਸਟੈਪ ਬਾਏ ਸਟੈਪ ਦੱਸਦੇ ਨੇ ਜੋ ਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲਗਦੀ ਹੈ ਅਤੇ ਮੈਨੂੰ ਉਹ ਸਾਰੀ ਚੀਜ਼ ਉਹਨਾਂ ਦੀ ਇੱਕ ਇੱਕ ਸਮਝ ਆਉਂਦੀ ਹੈ ਅਤੇ ਮੈਂ ਉਹਨਾਂ ਤੋਂ ਹੀ ਆਪਣਾ ਪੇਪਰ ਤਿਆਰ ਕਰਦੀ ਹਾਂ ਅਤੇ ਉਹ ਜ਼ਿਆਦਾਤਰ ਇੰਮਪੋਰਟੈਂਟ ਕੋਸ਼ਚਨਸ ਵੀ ਦੱਸ ਦਿੰਦੇ ਨੇ ਜਿਸ ਕਾਰਨ ਮੈਨੂੰ ਪੇਪਰ ਦੇਣ ਵਿੱਚ ਬਹੁਤ ਹੈਲਪ ਹੁੰਦੀ ਹੈ ਅਤੇ ਮੈਂ ਕਾਫੀ ਜ਼ਾਿਆਦਾ ਵਧੀਆ ਆਪਣੇ ਪੇਪਰ ਦੀ ਤਿਆਰੀ ਕਰਦੀ ਹਾਂ ਅਤੇ ਹੋਰ ਵੀ ਕੂਕਿੰਗ ਰਿਲੇਟਿਡ ਦੇਖਦੀ ਰਹਿੰਦੀ ਹਾਂ ਡਾਂਸਿੰਗ ਰਿਲੇਟਿਡ ਡਾਂਸ ਦੇ ਸਟੈਪ ਦੇਖਦੀ ਰਹਿੰਦੀ ਹਾਂ ਵੀ ਡਾਂਸ ਕਿਵੇਂ ਕੀਤਾ ਜਾਂਦਾ ਹੈ ਕਿਵੇਂ ਕਿ ਕਿਵੇਂ ਸਟੈਪ ਉਹਦੇ ਕੀਤੇ ਜਾਂਦੇ ਨੇ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਵਲੋਗ ਦੇਖਦੀ ਹਾਂ ਅਤੇ ਮੈਂ ਅ ਜਾ ਮੈਂ ਅਖ਼ਬਾਰ ਵੀ ਪੜ੍ਹਦੀ ਹਾਂ ਸਿਰਫ ਵਲੋਗ ਨਹੀਂ ਦੇਖਦੀ ਅਖ਼ਬਾਰ ਅਤੇ ਮੈਗਜ਼ੀਨ ਵੀ ਪੜ੍ਹਦੀ ਰਹਿੰਦੀ ਹਾਂ ਅਤੇ ਮੈਗਜ਼ੀਨ ਵਿੱਚ ਕਾਫੀ ਸਾਰੇ ਛਪਦੇ ਰਹਿੰਦੇ ਹਨ ਕੋਈ ਕੱਪੜੇ ਦੇ ਰਿਲੇਟਿਵ ਮੈਗਜ਼ੀਨ ਛਪਦੀਆਂ ਨੇ ਅਤੇ ਡਰੈਸਿਸ ਦੇ ਡਿਡਾ ਡਿਜ਼ਾਈਨ ਦੇਖਦੀ ਰਹਿੰਦੀ ਹਾਂ ਅਤੇ ਅਖ਼ਬਾਰਾਂ ਵਿੱਚ ਅੱਜ ਕੱਲ੍ਹ ਦੇ ਸਮੇਂ ਬਾਰੇ ਪਤਾ ਚੱਲਦਾ ਹੈ ਕਿ ਬਾਹਰ ਕੀ ਕੁਝ ਹੋ ਰਿਹਾ ਹੈ ਕੀ ਕੁਝ ਦੁਨੀਆ ਵਿੱਚ ਚੱਲ ਰਿਹਾ ਹੈ ਕੀ ਲੋਕ ਕੀ ਕੀ ਕਰ ਰਹੇ ਹਨ ਅਖ਼ਬਾਰਾਂ ਵਿੱਚ ਸਾਨੂੰ ਪਤਾ ਚੱਲਦਾ ਹੈ ਅਖ਼ਬਾਰ ਵੀ ਵਲੋਗ ਦੇਖਣ ਨਾਲ ਸਾਨੂੰ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ ਇਸ ਨਾਲ ਸਾਡੀ ਨੋਲੇਜ ਵਧਦੀ ਹੈ ਸਾਨੂੰ ਕਾਫੀ ਕੁਝ ਚੀਜ਼ਾਂ ਪਤਾ ਲੱਗਦੀਆਂ ਹਨ